ਜੀ ਹਾਂ ਅਸੀਂ ਘਰ ਵਿੱਚ ਤੁਲਸੀਂ ਅਤੇ ਹੋਰ ਜੜੀਆਂ ਬੂਟੀਆਂ ਵਰਗੇ ਔਸ਼ਦੀ ਪੌਦਿਆਂ ਨੂੰ ਕੁਦਰਤੀ ਉਗਾਉਂਦੇ ਹਾਂ ਜਿਵੇਂ ਕਿ ਘੀ ਘਿਓ ਇਹ ਸਾਡੀ ਚਮੜੀ ਲਈ ਬਹੁਤ ਵਧੀਆ ਔਸ਼ਦੀ ਹੈ ਤੁਲਸੀ ਨਾਲ ਗਲ਼ੇ ਜੁਕਾਮ ਅਤੇ ਬੁਖਾਰ ਵਰਗੀਆਂ ਬਿਮਾਰੀਆਂ ਤੋਂ ਬਚਾਅ ਬਣਿਆ ਰਹਿੰਦਾ ਹੈ ਹਲਦੀ ਅਤੇ ਨਿੰਮ ਦਾ ਵੀ ਬਹੁਤ ਕੁਦਰਤੀ ਔਸ਼ਦੀ ਹੈ ਜੋ ਅਸੀਂ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵਰਤਦੇ ਹਾਂ ਇਹਨਾਂ ਕੁਦਰਤੀ ਔਸ਼ਦੀਆਂ ਲਈ ਕੋਈ ਨੁਕਸਾਨ ਨਹੀਂ ਹੈ ਅਤੇ ਇਹ ਸਾਡੀ ਬਿਮਾਰੀਆਂ ਦਾ ਕੁਦਰਤੀ ਤੌਰ 'ਤੇ ਉਪਚਾਰ ਕਰਨ ਵਿੱਚ ਸਹਾਇਕ ਹੁੰਦੀਆਂ ਹਨ ਅਤੇ ਇਹ ਆਸਾਨੀ ਨਾਲ ਘਰਾਂ ਵਿੱਚ ਉਪਲਬਧ ਹੋ ਜਾਂਦੀਆਂ ਹਨ ਇਸ ਕਰਕੇ ਐਂਟੀ ਬਾਓਟਿਕਸ ਨਾਲੋਂ ਘਰੇਲੂ ਅਤੇ ਕੁਦਰਤੀ ਔਸ਼ਦੀਆਂ ਉਗਾਉਣਾ ਅਤੇ ਵਰਤਣਾ ਮੈਨੂੰ ਚੰਗਾ ਲੱਗਦਾ ਹੈ